ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਧੋਤੀ ਕੁੜਤਾ ਅਤੇ ਪੱਗੜੀ ਜੁੱਤੀ ਪਾਈ ਜਾਂਦੀ ਹੈ ਮੇਰੇ ਅਨੁਸਾਰ ਪੋਸ਼ਾਕਾਂ ਡਾਂਸ ਕਰਨ ਵਾਲਿਆਂ ਨੂੰ ਬਹੁਤ ਆਕਰਸ਼ਿਤ ਬਣਾਉਂਦੀ ਹੈ ਕਿਉਂਕਿ ਇਸ ਤੋਂ ਉਹ ਆਪਦੇ ਭੰਗੜੇ ਨੂੰ ਇੱਕ ਵਧੀਆ ਰੂਪ ਦੇ ਦਿੰਦੇ ਹਨ ਅਤੇ ਉਹ ਭੰਗੜੇ ਦੇ ਗੀਤ ਵਿੱਚ ਇੱਕੋ ਜਿਹੇ ਲੱਗਦੇ ਹਨ